ਮੇਰੀ ਮਨਪਸੰਦ ਖੇਡ ਬੈਟ ਬੋਲ ਲਗਾ ਲਓ ਅਤੇ ਜਾਂ ਫਿਰ ਬੈਡਮਿੰਟਨ ਲਾ ਲਉ ਚਿੜੀ ਛਿੱਕਾ ਇਹ ਅਸੀਂ ਦੋਨੋਂ ਚੀਜ਼ਾਂ ਬਹੁਤ ਖੇਲੀਆਂ ਦੋਨੋਂ ਖੇਡਾਂ ਜਿਹੜੀਆਂ ਨੇ ਉਹ ਕਸਰਤ ਵੀ ਕਰਾ ਦਿੰਦੀਆਂ ਨੇ ਦਿਮਾਗ ਨੂੰ ਫਰੈਸ਼ ਵੀ ਕਰ ਦਿੰਦੀਆਂ ਨੇ ਤਾਜ਼ਾ ਵੀ ਕਰ ਦਿੰਦੀਆਂ ਨੇ ਅਤੇ ਰਾਤ ਦੀ ਰੋਟੀ ਜਿਹੜੀ ਖਾ ਕੇ ਜੇ ਤੁਸੀਂ ਸੈਰ ਕਰਦੇ ਹੋ ਜਾਂ ਥੋੜ੍ਹਾ ਜਿਹਾ ਖੇਲਦੇ ਹੋ ਅਤੇ ਉਹ ਤੁਹਾਨੂੰ ਜਿਹੜਾ ਉਹ ਬੜੀ ਵਧੀਆ ਇੱਕ ਤੁਹਾਨੂੰ ਸਰੀਰ ਦੀ ਮਜ਼ਬੂਤੀ ਵੀ ਬਖਸ਼ੇਗੀ ਨਾਲੇ ਤੁਹਾਡਾ ਖਾਣਾ ਜਿਹੜਾ ਉਹ ਪਚੇਗਾ ਵੀ ਛੋਟੇ ਹੁੰਦਿਆਂ ਜਾਂ ਹੁਣ ਵੀ ਕਦੇ ਕਦਾਈਂ ਅਸੀਂ ਖੇਡਣ ਜਾਂਦੇ ਹਾਂ ਅਤੇ ਬਹੁਤ ਮਜ਼ਾ ਆਉਂਦਾ ਹੈ ਯਾਰ ਦੋਸਤ ਮਿਲਦੇ ਹਾਂ ਹੱਸਦੇ ਹਾਂ ਭੱਜ ਨੱਠ ਹੁੰਦੀ ਹੈ ਬੜੀਆਂ ਵਿੱਚ ਗੱਲਾਂ ਹੁੰਦੀਆਂ ਨੇ ਬੋਲ ਲੈ ਬੋਲ ਗੁਆਚ ਜਾਂਦੀ ਹੈ ਕਦੇ ਬੈਟ ਟੁੱਟ ਜਾਂਦਾ ਚਿੜੀ ਛਿੱਕੇ ਅਤੇ ਇੱਦਾਂ ਹੁੰਦਾ ਸੀਗਾ ਅਸੀਂ ਰਾਤ ਨੂੰ ਜਾਂਦੇ ਸੀ ਰੋਟੀ ਖਾਣ ਤੋਂ ਬਾਅਦ ਘੰਟਾ ਡੇਢ ਘੰਟਾ ਖੇਡ ਕੇ ਜਦੋਂ ਘਰ ਵਾਪਸ ਆਉਣਾ ਦੁਬਾਰਾ ਭੁੱਖ ਲੱਗ ਜਾਂਦੀ ਸੀ ਬਟ ਪਾਣੀ ਪੀ ਕੇ ਜਾਂ ਦੁੱਧ ਪੀ ਕੇ ਸੌਂ ਜਾਈਦਾ ਸੀ ਇਹ ਯਾਦਾਂ ਜਿਹੜੀਆਂ ਨੇ ਇਹ ਬਹੁਤ ਅੱਜ ਵੀ ਯਾਦ ਆਉਂਦੀ ਹੈ ਪਰ ਅੱਜ ਦੇ ਸਮੇਂ ਦੇ ਹਿਸਾਬ ਨਾਲ ਸਾਨੂੰ ਇਸ ਚੀਜ਼ਾਂ ਨੂੰ ਖੇਡਣ ਲਈ ਜਗ੍ਹਾ ਵੀ ਨਹੀਂ ਮਿਲਦੀ ਕਿਉਂਕਿ ਖਾਲੀ ਜਗ੍ਹਾ ਇੱਥੇ ਰਹੀ ਨਹੀਂ ਸ਼ਹਿਰਾਂ ਵਿੱਚ ਪਿੰਡਾਂ 'ਚ ਲੋਕ ਖੇਡਦੇ ਦੇਖਦੇ ਹਾਂ ਅਤੇ ਯਾਦ ਆਉਂਦੀ ਆ ਪੁਰਾਣੇ ਖੇਡਾਂ ਦੀ ਕਿ ਯਾਰ ਅਸੀਂ ਵੀ ਕਦੇ ਕਦੇ ਇੱਦਾਂ ਖੇਡਦੇ ਹੁੰਦੇ ਸੀਗੇ